ਖੇਡਾਂ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬੜਾ ਮਹੱਤਵਪੂਰਨ ਹਿੱਸਾ ਹੁੰਦਾ ਹੈ ਬਹੁਤ ਵਧੀਆ ਰੋਲ ਅਦਾ ਕਰਦੀਆਂ ਹਨ ਖੇਡਾਂ ਸਾਡੇ ਸਰੀਰ ਦੇ ਵਿੱਚ ਸਾਡੇ ਸਰੀਰ ਨੂੰ ਅਰੋਗ ਰੱਖਦੀਆਂ ਤਕੜਾ ਰੱਖਣ ਵਿੱਚ ਆਪਣਾ ਮਹੱਤਵਪੂਰਨ ਹਿੱਸਾ ਨਿਭਾਉਂਦੀਆਂ ਹਨ ਸਾਡੇ ਖੇਡਣ ਦੇ ਨਾਲ ਸਾਨੂੰ ਤਾਜ਼ਗੀ ਮਿਲਦੀ ਹੈ ਵਿਦਿਆਰਥੀ ਜੀਵਨ ਦੇ ਵਿੱਚ ਤਾਂ ਇਹ ਸੋਗੇ ਸੋਨੇ 'ਤੇ ਸੁਹਾਗੇ ਦਾ ਕੰਮ ਕਰਦੀਆਂ ਹਨ ਸਿਰਫ਼ ਸਰੀਰਕ ਅਰੋਗਤਾ ਨਹੀਂ ਦਿੰਦੀਆਂ ਸਾਡੇ ਦਿਮਾਗ ਨੂੰ ਵੀ ਤਾਕਤ ਦਿੰਦੀਆਂ ਹਨ ਖੇਡਾਂ ਖੇਡਣ ਨਾਲ ਦਿਮਾਗ ਦੀ ਯਾਦ ਸ਼ਕਤੀ ਵੱਧਦੀ ਹੈ ਦਿਮਾਗ ਤਾਜ਼ਾ ਅਤੇ ਚੁਸਤ ਰਹਿੰਦਾ ਹੈ ਹਮੇਸ਼ਾ ਪੜ੍ਹਦੇ ਰਹਿਣ ਵਾਲਾ ਬੱਚਾ ਜ਼ਿੰਦਗੀ ਵਿੱਚ ਕਈ ਧੱਕੇ ਨਹੀਂ ਕਰ ਸਕਦਾ ਕਿਉਂਕਿ ਪੜ੍ਹ ਪੜ੍ਹ ਕੇ ਉਹਦਾ ਸਰੀਰ ਅਤੇ ਦਿਮਾਗ ਥੱਕ ਚੁੱਕੇ ਹੁੰਦੇ ਹਨ ਇਸਦੇ ਉਲਟ ਜਿਹੜਾ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ 'ਚ ਸਮਾਂ ਕੱਢਦਾ ਉਹ ਖੂਬ ਤਰੱਕੀ ਕਰਦਾ ਹੈ ਖੇਡਾਂ ਸਾਡੇ ਆਚਰਨ ਦੀ ਉਸਾਰੀ 'ਚ ਬੜਾ ਯੋਗਦਾਨ ਪਾਉਂਦੀਆਂ ਹਨ ਖੇਡਾਂ ਖੇਡਦੇ ਸਮੇਂ ਬੰਦਾ ਬਾਹਰੀ ਫਿਕਰਾਂ ਝੰਜਟਾਂ ਤੋਂ ਮੁਕਤ ਹੋ ਜਾਂਦਾ ਕਈ ਇਹਦੇ ਨਾਲ ਮਨ ਵਿੱਚ ਇੱਕ ਟਿਕਾਅ ਆ ਜਾਂਦਾ ਸੰਸਾਰਿਕ ਫਿਕਰਾਂ ਸੋਚਾਂ ਤੋਂ ਮੁਕਤ ਹੋ ਕੇ ਉਹਦਾ ਮਨ ਨੱਚ ਉੱਠਦਾ ਹੈ ਖੇਡਦੇ ਸਮੇਂ ਉਹ ਖੁੱਲ੍ਹ ਕੇ ਹੱਸਦਾ ਹੈ ਉਹਦਾ ਮਨ ਖਿੜਿਆ ਰਹਿੰਦਾ ਹੈ ਸਾਡੇ ਖੇਡਾਂ ਖੇਡਦੇ ਸਮੇਂ ਸਾਡੇ ਮਨ ਵਿੱਚ ਜਿੱਤ ਦੀ ਆਸ ਹੁੰਦੀ ਹੈ ਕਦੇ ਹਾਰ ਜਾਣ 'ਤੇ ਅਸੀਂ ਜਿੱਤ ਦੀ ਆਸ ਨਹੀਂ ਛੱਡਦੇ ਇਸ ਤਰ੍ਹਾਂ ਇਹ ਜਿੱਤ ਦੀ ਆਸ ਸਾਨੂੰ ਜ਼ਿੰਦਗੀ ਵਿੱਚ ਆਸ਼ਾਵਾਦੀ ਬਣਾਉਣ ਵਿੱਚ ਸਹਾਇਤਾ ਕਰਦੀ ਹੈ ਕਈ ਵਾਰ ਕਈ ਮਜ਼ਬੂਰੀਆਂ ਕਾਰਨ ਬੱਚੇ ਬਾਹਰ ਖੇਡਣ ਲਈ ਨਹੀਂ ਜਾ ਸਕਦੇ ਜਿਵੇਂ ਕਿ ਬਾਰਿਸ਼ ਆ ਗਈ ਜਾਂ ਘਰ ਤੋਂ ਪਾਰਕ ਦਾ ਦੂਰ ਹੋਣਾ ਜਾਂ ਪੜ੍ਹਾਈ ਦੇ ਵਿੱਚੋਂ ਸਮਾਂ ਹੀ ਰਾਤ ਨੂੰ ਮਿਲਦਾ ਖੇਡਣ ਦਾ ਅਤੇ ਉਹ ਘਰ ਤੋਂ ਬਾਹਰ ਜਾ ਕੇ ਨਹੀਂ ਖੇਡ ਸਕਦੇ ਉਹਨਾਂ ਲਈ ਹੀ ਘਰ ਦੇ ਅੰਦਰ ਇਨਡੋਰ ਖੇਡਾਂ ਦਾ ਕਾਫ਼ੀ ਸਾਨੂੰ ਸਹੂਲਤ ਪ੍ਰਾਪਤ ਹੈ ਜਿਵੇਂ ਕਿ ਲੂਡੋ ਹੋ ਗਈ ਕੈਰਮ ਹੋ ਗਿਆ ਸੱਪ ਸੀਡੀ ਹੋ ਗਈ ਸ਼ਤਰੰਜ ਹੋ ਗਈ ਮਾਰਬਲ ਹੋ ਗਈ ਇਹਨਾਂ ਖੇਡਾਂ ਦੇ ਨਾਲ ਬੱਚਿਆਂ ਦਾ ਕਾਫ਼ੀ ਮਨ ਪ੍ਰਚਾਵਾ ਹੋ ਜਾਂਦਾ ਮੈਂ ਤਾਂ ਆਪ ਵੀ ਜਦੋਂ ਆਪਣੇ ਘਰ ਦੇ ਕੰਮ ਤੋਂ ਬਹੁਤ ਥੱਕ ਚੁੱਕੀ ਹੁੰਦੀ ਹਾਂ ਬਹੁਤ ਜ਼ਿਆਦਾ ਦਿਲ ਕਰਦਾ ਕਿ ਹੁਣ ਕੁਝ ਕੁਛ ਕੀਤਾ ਜਾਵੇ ਕੁਛ ਖੇਡਿਆ ਜਾਵੇ ਥੋੜ੍ਹਾ ਜਿਹਾ ਆਪਣੇ ਮਨ ਨੂੰ ਘਰ ਦੇ ਕੰਮਾਂ ਤੋਂ ਬਾਹਰ ਕੱਢਿਆ ਜਾਵੇ ਹੱਸਿਆ ਜਾਵੇ ਅਤੇ ਮੈਂ ਆਪਣੇ ਬੱਚਿਆਂ ਦੇ ਨਾਲ ਆਪਣਾ ਟਾਈਮ ਸਪੈਂਡ ਕਰਨ ਲਈ ਆਪਣਾ ਟਾਈਮ ਬਿਤਾਉਣ ਲਈ ਇਨਡੋਰ ਗੇਮਾਂ ਦਾ ਸਹਾਰਾ ਲੈਂਦੀ ਹਾਂ ਅਸੀਂ ਲੂਡੋ ਖੇਡਦੇ ਹਾਂ ਤਾਸ਼ ਖੇਡਦੇ ਹਾਂ ਤਾਸ਼ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਗੇਮਾਂ ਆ ਜਾਂਦੀਆਂ ਭਾਬੋ ਰੰਮੀ ਸੀਪ ਇਸੇ ਤਰ੍ਹਾਂ ਹੀ ਲੂਡੋ ਦੇ ਵਿੱਚ ਸੱਪ ਸੀਡੀ ਆ ਗਿਆ ਚਾਰ ਖ਼ਾਨਿਆਂ ਵਾਲੀ ਗੇਮ ਹੋ ਗਈ ਬੱਚਿਆਂ ਦੇ ਵਿੱਚ ਜਿੱਤਣ ਦੀ ਇੱਕ ਪ੍ਰਵਿਰਤੀ ਆਉਂਦੀ ਹੈ ਹਾਰਨ 'ਤੇ ਵੀ ਉਹ ਦੁਖੀ ਨਹੀਂ ਹੁੰਦੇ ਅਤੇ ਮੈਨੂੰ ਆਪ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਜਦੋਂ ਮੈਂ ਬੱਚਿਆਂ ਨੂੰ ਹੱਸਦਿਆਂ ਦੇਖਦੀ ਹਾਂ ਖੁਸ਼ ਹੁੰਦਿਆਂ ਦੇਖਦੀ ਹਾਂ ਇੱਕ ਮਾਂ ਬਾਪ ਲਈ ਆਪਣੇ ਬੱਚਿਆਂ ਦੇ ਮੂੰਹ 'ਤੇ ਖੁਸ਼ੀ ਦੇਖਣੀ ਹੀ ਸਭ ਤੋਂ ਵੱਡੀ ਚੀਜ਼ ਹੁੰਦੀ ਆ